ਰਾਜ ਸਰਕਾਰ ਇੰਨਾ ਸਿਹਤ ਚਿੰਤਾਵਾਂ ਨੂੰ ਕਈ ਤਰੀਕਿਆਂ ਨਾਲ ਹੱਲ ਕਰ ਰਹੀ ਹੈ ਸਮੇਂ ਸਮੇਂ 'ਤੇ ਇਹਨਾਂ ਬਿਮਾਰੀਆਂ ਦਾ ਪਤਾ ਲਗਾਇਆ ਜਾਂਦਾ ਹੈ ਟੈਸਟ ਕੀਤੇ ਜਾਂਦੇ ਹਨ ਗਲੀ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਦੱਸਿਆ ਜਾਂਦਾ ਹੈ ਕਿ ਇਹਨਾਂ ਬਿਮਾਰੀਆਂ ਪਤ ਪ੍ਰਤੀ ਹਸਪਤਾਲਾਂ ਵਿੱਚ ਦਵਾਈ ਟੈਸਟ ਮੁਫ਼ਤ ਕੀਤੇ ਜਾਂਦੇ ਹਾਂ ਕੀਤੇ ਜਾਣਗੇ ਇਹਨਾਂ ਦਾ ਮੌਕੇ ਦਾ ਫਾਇਦਾ ਉਠਾਓ ਉਸ ਸਮੇਂ ਇਹ ਸਿਹਤ ਸੰਸਥਾਵਾਂ ਸਭ ਤੋਂ ਜ਼ਿਆਦਾ ਆਪਣੇ ਕੰਮ ਵਿਚ ਰੁਝੀਆਂ ਹੁੰਦੀਆਂ ਹਨ ਜਦੋਂ ਕੋਈ ਇਹਨਾਂ ਰੋਗਾਂ ਦਾ ਜ਼ਿਆਦਾ ਜ਼ੋਰ ਹੁੰਦਾ ਹੈ ਜਿਵੇਂ ਬਰਸਾਤ ਦੇ ਸ਼ੁਰੂ ਹੋਣ ਸਮੇਂ ਸਰਦੀਆਂ ਸ਼ੁਰੂ ਹੋਣ ਸਮੇਂ ਜਾਂ ਗਰਮੀਆਂ ਸ਼ੁਰੂ ਹੋਣ ਸਮੇਂ ਇਸ ਤਰ੍ਹਾਂ ਹੀ ਜਦੋਂ ਸਰਦੀਆਂ ਖ਼ਤਮ ਹੁੰਦੀਆਂ ਹਨ ਉਦੋਂ ਵੀ ਇਵਮ ਰੋਕ ਬੰਦੇ ਨੂੰ ਆਪਣੇ ਕਾਬੂ 'ਚ ਲੈ ਲੈਂਦੇ ਹਨ ਗਰਮੀ ਖ਼ਤਮ ਹੋਣ 'ਤੇ ਵੀ ਇਸ ਤਰ੍ਹਾਂ ਅਜਿਹਾ ਹੀ ਹੁੰਦਾ ਹੈ ਇਸੇ ਤਰ੍ਹਾਂ ਬਰਸਾਤ ਖ਼ਤਮ ਹੋਣ 'ਤੇ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਸਿਹਤ ਸੰਸਥਾਵਾਂ ਇਹਨਾਂ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੀਆਂ ਹਨ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਆਪਣੇ ਆਪ ਹਰ ਰਾਜ ਵਿੱਚ ਹਰ ਜਗ੍ਹਾ 'ਤੇ ਥੋੜ੍ਹੀ ਥੋੜ੍ਹੀ ਦੂਰੀ 'ਤੇ ਸਿਹਤ ਸੰਸਥਾਵਾਂ ਦੇ ਕੇਂਦਰ ਹਨ ਜੋ ਸਰਕਾਰ ਵੱਲੋਂ ਸਹੂਲਤਾਂ ਦੇ ਰਹੇ ਹਨ ਮੁਫ਼ਤ ਮੁਫ਼ਤ ਚੈੱਕਅਪ ਕੀਤੇ ਜਾ ਰਹੇ ਹਨ ਮੁਕਤ ਫ਼ ਮੁਫ਼ਤ ਟੀਕਾਕਰਨ ਕੀਤੇ ਜਾ ਰਹੇ ਹਨ ਅਤੇ ਮੁਫ਼ਤ ਹੀ ਦਵਾਈ ਦਿੱਤੀ ਜਾ ਰਹੀ ਹੈ ਸਾਨੂੰ ਲੋਕਾਂ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਤੰਦਰੁਸਤ ਰਿਹਾ ਜਾ ਸਕੇ ਤੰਦਰੁਸਤ ਸਰੀਰ ਹੀ ਹਰ ਤਰ੍ਹਾਂ ਦੇ ਕੰਮ ਕਰਨ ਦੇ ਕਾਬਲ ਹੁੰਦਾ ਹੈ ਧੰਨਵਾਦ